ਸਤਿ ਸ਼੍ਰੀ ਅਕਾਲ ਜੀ ਮੈਂ ਗਗਨਪ੍ਰੀਤ ਕੌਰ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਦੋ ਦਰਿਆ ਟੁੱਟ ਗਏ ਹਨ ਜਿਸ ਕਰਕੇ ਡੇਢ ਦਰਿਆ ਹੋ ਗਏ ਹਨ ਅਤੇ ਇੱਥੇ ਪਾਣੀ ਦੇ ਸਰੋਤ ਵੀ ਸਰੋਤ ਵੀ ਘੱਟ ਗਿਆ ਹੈ ਅਤੇ ਇੱਥੇ ਮਤਲਬ ਕਿ ਪਲਿਊਸ਼ਨ ਬਹੁਤ ਜ਼ਿਆਦਾ ਹੈ ਅਤੇ ਆਹ ਮੈਦਾਨੀ ਖੇਤਰ ਹੈ ਪੰਜਾਬ ਅਤੇ ਇੱਥੇ ਫ਼ਸਲਾਂ ਵਗੈਰਾ ਬਹੁਤ ਵਧੀਆ ਲੱਗਦੀਆਂ ਹਨ ਅਤੇ ਗੱਡੀਆਂ ਅਤੇ ਵਾਹੀਕਲ ਕਰਕੇ ਪਲਿਊਸ਼ਨ ਪਲਿਊਸ਼ਨ ਜ਼ਿਆਦਾ ਵੱਧ ਗਿਆ ਅਤੇ ਫੈਕਟਰੀਆਂ ਦਾ ਫੈਕਟਰੀਆਂ ਦੇ ਧੂੰਏ ਅਤੇ ਗੰਦੇ ਪਾਣੀ ਕਰਕੇ ਪੋਲਿਊਸ਼ਨ ਜ਼ਿਆਦਾ ਹੋ ਰਿਹਾ ਅਤੇ ਗੰਦਾ ਪਾਣੀ ਜਿਹੜਾ ਹੈ ਉਹ ਨਦੀਆਂ ਵਿੱਚ ਚਲ ਜਾਂਦਾ ਹੈ ਫੈਕਟਰੀਆਂ ਦਾ ਅਤੇ ਜਿਸ ਕਰਕੇ ਪਾਣੀ ਵੀ ਸਾਫ਼ ਨਹੀਂ ਰਿਹਾ ਅਤੇ ਇੱਥੇ ਜੰਗਲ ਪਹਾੜ ਪਹਾੜੀਆਂ ਸਮੁੰਦਰ ਖੇਤ ਮਿੱਟੀ ਮਿੱਟੀ ਵਾਲਾ ਮਿੱਟੀ ਵਾਲਾ ਖੇਤਰ ਵੀ ਹੈ ਅਤੇ ਇੱਥੇ ਮਿੱਟੀ ਵੀ ਹੁਣ ਇੰਨੀ ਵਧੀਆ ਨਹੀਂ ਰਹੀ ਕਿ ਆਹ ਆਹ ਗਰਮੀ ਵੇਲੇ ਪੰਜਾਬ ਵਿੱਚ ਗਰਮੀ ਵੇਲੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਅਤੇ ਸਰਦੀ ਵੇਲੇ ਬਹੁਤ ਜ਼ਿਆਦਾ ਸਰਦੀ ਹੋ ਜਾਂਦੀ ਹੈ ਸਰਦੀ ਵੇਲੇ ਬਹੁਤ ਜ਼ਿਆਦਾ ਸਰਦੀ ਹੋ ਜਾਂਦੀ ਹੈ ਅਤੇ ਇੱਥੇ ਬਿਨ ਮੌਸਮ ਬਰਸਾਤ ਹੋ ਜਾਂਦੀ ਜਿੱਦਾਂ ਅਪ੍ਰੈਲ ਦਾ ਮਹੀਨਾ ਅਪ੍ਰੈਲ ਦੇ ਮਹੀਨੇ ਵਿੱਚ ਬਰਸਾਤ ਨਹੀਂ ਹੁੰਦੀ ਤਾਂ ਵੀ ਇੱਥੇ ਬਰਸਾਤ ਹੋ ਜਾਂਦੀ ਹੈ ਅਪ੍ਰੈਲ ਦੇ ਮਹੀਨੇ ਵਿੱਚ ਕਟਾਈ ਦਾ ਮਹੀਨਾ ਹੁੰਦਾ ਹੈ ਇਹਦੇ ਵਿੱਚ ਕਣਕ ਦੀ ਕਟਾਈ ਹੋਣੀ ਹੁੰਦੀ ਹੈ ਪਰ ਇਹਦੇ ਵਿੱਚ ਕਣਕ ਦੀ ਕਟਾਈ ਵੇਲੇ ਬਰਸਾਤ ਪੈ ਜਾਂਦੀ ਹੈ ਜਿਸ ਕਰਕੇ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ ਅਤੇ ਫ਼ਸਲਾਂ ਖ਼ਰਾਬ ਹੋਣ ਕਰਕੇ ਸਾ ਪੰਜਾਬ ਵਿੱਚ ਬਹੁਤ ਜ਼ਿਆਦਾ ਫਸ ਨੁਕਸਾਨ ਮਤਲਬ ਕਿ ਖੇਤੀ ਦੇ ਵਿੱਚ ਵੀ ਨੁਕਸਾਨ ਹੋ ਰਿਹਾ ਅਤੇ ਪਲਿਊਸ਼ਨ ਕਰਕੇ ਵੀ ਮਤਲਬ ਕਿ ਬਹੁਤ ਜ਼ਿਆਦਾ ਬਿਮਾਰੀਆਂ ਫੈਲ ਰਹੀਆਂ ਜਿੱਦਾਂ ਕਿ ਕੋਵਿਡ ਨਾਈਨਟੀਨ ਦੀ ਬਿਮਾਰੀ ਆ ਪਲਿਊਸ਼ਨ ਕਰਕੇ ਬਹੁਤ ਜ਼ਿਆਦਾ ਫੈਲ ਰਹੀ ਹੈ ਅ ਆਈਫਲੂ ਅਤੇ ਬੁਖਾਰ ਇੱਦਾਂ ਦੀਆਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਫੈਲ ਰਹੀਆਂ ਕੁਛ ਬੁਖ਼ਾਰਾਂ ਨੇ ਅਤੇ ਮਤਲਬ ਕਿ ਪੰਜਾਬ ਵਿੱਚ ਇੰਨਾ ਜ਼ਿਆਦਾ ਬੁਖ਼ਾਰ ਹੋ ਗਏ ਸੀ ਕਿ ਲੋਕਾਂ ਦਾ ਚੱਲਣਾ ਫਿਰਨਾ ਕੰਮ ਕਰਨਾ ਤਾਂ ਬਹੁਤ ਜ਼ਿਆਦਾ ਔਖਾ ਹੋਇਆ ਸੀ ਅਤੇ ਕੋਵਿਡ ਨਾਈਨਟੀਨ ਕਰਕੇ ਮਤਲਬ ਕਿ ਸਕੂਲ ਵੀ ਸਾਲ ਦੋ ਸਾਲ ਬੰਦ ਰਹੇ ਸੀ ਅਤੇ ਜ਼ਿਆਦਾ ਗਰਮੀ ਅਤੇ ਜ਼ਿਆਦਾ ਸਰਦੀ ਵੀ ਹੋ ਜਾਂਦੀ ਹੈ ਜਿਸ ਕਰਕੇ ਸਰਦੀਆਂ ਵੇਲੇ ਵੀ ਬੱਚਿਆਂ ਨੂੰ ਛੁੱਟੀਆਂ ਦੇ ਦਿੱਤੀਆਂ ਜਾਂਦੀਆਂ